ਤੇਰ੍ਹਾਂ ਚਾਰ ਉੱਨੀ ਸੌ ਤੇਰ੍ਹਾਂ ਦਸ ਚਾਰ ਉੱਨੀ ਸੌ ਇਕਿਆਸੀ ਦਸ ਦਸ ਉੱਨੀ ਸੌ ਚੁਰਾਸੀ ਦੋ ਦੋ ਉੱਨੀ ਸੌ ਬਾਰ੍ਹਾਂ